ਘਰ ਵਿੱਚ ਬਗੀਚੇ ਬਣਾਉਣ ਦਾ ਖਰਚ ਕਈ ਫੈਕਟਰਸ 'ਤੇ ਨਿਰਭਰ ਕਰਦਾ ਹੈ ਜੇ ਜਿਵੇਂ ਕਿ ਵਿਸਤਾਰ ਬਗੀਚੇ ਦਾ ਵਿਸਤਾਰ ਕਿੰਨਾ ਹੈ ਉਸਦੀ ਵੱਧ ਤੋਂ ਵੱਧ ਵਾਇਰਲ ਪੈਸਟਲ ਆਪਣੇ ਜੈਵਿਕ ਸਮੱਗਰੀ ਦੀ ਖਰੀਦ ਕਰਨ ਦੀ ਜ਼ਰੂਰਤ ਹੋਵੇਗੀ ਫਸਲਾਂ ਫਸਲਾਂ ਦਾ ਚੋਣ ਕਿਹਨਾਂ ਵਰਗਾ ਹੈ ਅਤੇ ਇਹ ਵੀ ਕਿਹੜੇ ਉੱਚਿੱਤ ਕਰਨਗੇ ਉੱਧਰ ਸਮੱਗਰੀ ਬਗੀਚੇ ਵਿੱਚ ਵੱਧ ਤੋਂ ਵੱਧ ਕੈਨਾਪਰ ਗ੍ਰਾਮ ਕਿੰਨੇ ਪੈਸੇ ਦੇ ਬਦਲ ਵਿੱਚ ਕਹਿਣ ਦੀ ਜ਼ਰੂਰਤ ਹੈ ਉਹਨਾਂ ਦੀ ਕੀਮਤ ਕਿੱਦਾਂ ਹੈ ਘਰ ਵਿੱਚ ਬਗੀਚੇ ਬਣਾਉਣ ਦੇ ਕਈ ਫ਼ਾਇਦੇ ਹੁੰਦੇ ਹਨ ਸੁਹਾਵਣਾ ਦ੍ਰਿਸ਼ਟੀਕੋਣ ਬਗੀਚੇ ਨੇ ਘਰ ਦੇ ਵਿਚਾਰ ਨੂੰ ਸੁਹਾਵਣਾ ਬਣਾਉਂਦਾ ਹੈ ਅਤੇ ਘਰ ਦੇ ਨਜ਼ਦੀਕੀ ਲੋਕਾਂ ਨੂੰ ਅਮੀਰਪਨ ਅਤੇ ਸੁੱਖ ਦਾ ਅਨੁਭਵ ਕਰਨ ਦਿੰਦਾ ਹੈ ਹਵਾ ਦੇ ਗੁਣ ਬਗੀਚੇ ਨੇ ਘਰ ਦੇ ਨਾਲ ਹਵਾ ਨੂੰ ਸਾਫ਼ ਅਤੇ ਤਾਜ਼ਗੀ ਦੇਣ ਵਿੱਚ ਮਦਦ ਕਰਦਾ ਹੈ ਇਹ ਮਨੁੱਖ ਸਿਹਤ ਅਤੇ ਵਿਚਾਰ ਸ਼ਕਤੀ ਨੂੰ ਵਧਾਉਂਦਾ ਹੈ ਖੇਤੀ ਅਤੇ ਖੇਤੀ ਕਰਨ ਦਾ ਮੌਕਾ ਬਗੀਚੇ ਵਿੱਚ ਫਸਲਾਂ ਅਤੇ ਪੌਦੇ ਲਗਾਉਣਾ ਅਤੇ ਖੇਤੀ ਦਾ ਅਨੁਭਵ ਮਿਲਦਾ ਹੈ ਜੋ ਖਾਣ ਦੇ ਨਵੇਂ ਸ਼ੁਰੂਆਤੀ ਅਤੇ ਸੂਸਤ ਅਕਰਮਨ ਲਈ ਵਧੀਆ ਹੋਵੇਗਾ ਇਹ ਫ਼ਾਇਦੇ ਹਨ ਜੋ ਘਰ ਵਿੱਚ ਬਗੀਚੇ ਬਣਾਉਣ ਦੇ ਵਿਚਾਰ ਵਿੱਚ ਸ਼ਾਮਿਲ ਹੁੰਦੇ ਹਨ